ਪਿੰਡ ਵਿੱਚ ਬਿਜਲੀ ਲਈ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਹਨ ਸੂਰਜੀ ਊਰਜਾ ਸੂਰਜੀ ਊਰਜਾ ਪੈਨਲ ਦਾ ਉਪਯੋਗ ਕਰਕੇ ਖੇਤਾਂ ਵਿੱਚ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ ਕੀਪਿੰਗ ਸਿਸਟਮ ਪਾਣੀ ਦੇ ਪੰਪਾਂ ਨੂੰ ਚਲਾਉਣ ਲਈ ਬਿਜਲੀ ਦੀ ਵਰਤੋਂ ਕਰਕੇ ਜਲ ਸਾਧਨ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ ਟਿੱਪਣੀ ਇਨ ਮਸ਼ੀਨਰੀ ਉਤਪਾਦਨ ਵਿੱਚ ਸੁਧਾਰ ਲਈ ਬਿਜਲੀ ਦੀਆਂ ਮਸ਼ੀਨਰੀ ਜਿਵੇਂ ਕਿ ਟਰੈਕਟਰ ਲਈ ਈਜੀ ਰੋ ਲੈਡਰ ਲੋਡਰ ਆਦਿ ਦਾ ਉਪਯੋਗ ਸਮਾਰਟ ਕਿੱਟ ਖੇਤੀ ਸੈਂਸਰ ਅਤੇ ਆਟੋਮੈਟਿਕ ਸਿਸਟਮਾਂ ਨਾਲ ਖੇਤੀ ਵਿੱਚ ਬਿਜਲੀ ਦੀ ਸਹਾਇਤਾ ਨਾਲ ਫਸਲਾਂ ਦੀ ਦੇਖਭਾਲ ਕਰਨਾ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਮਸ਼ੀਨਾਂ ਉਪਕਰਨ ਜੋ ਸੂਰਜੀ ਊਰਜਾ ਚੱਲਦੇ ਹਨ ਜਿਵੇਂ ਕਿ ਪਾਣੀ ਦੇ ਪੰਪ ਫਰਟੀਲਾਈਜ਼ਰ ਸਪਰੇ ਆਦਿ ਇਸ ਤਰ੍ਹਾਂ ਪਿੰਡਾਂ ਵਿੱਚ ਖੇਤੀ ਨੂੰ ਬਿਜਲੀ ਸਹੂਲਤਾਂ ਦੇ ਕੇ ਪ੍ਰਦੂਸ਼ਣ ਘਟਾਉਣ ਅਤੇ ਖੇਤੀਬਾੜੀ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ ਇਸ ਤਰ੍ਹਾਂ ਹੋ ਰਹੀਆਂ ਵੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਿਜਲੀ 'ਤੇ ਨਿਰਭਰ ਹਨ ਅਤੇ ਨਵੀਂ ਤਕਨੀਕਾਂ ਤਕਨੀਕਾਂ ਨਾਲ ਜੋ ਕਿ ਖੇਤੀ ਵਿੱਚ ਕੀਤੀਆਂ ਜਾ ਸਕਦੀਆਂ ਹਨ ਹਵਾ ਵਿੱਚ ਊਰਜਾ ਨੂੰ ਬਿਜਲੀ ਵਿੱਚ ਬਦਲਣ ਲਈ ਹਵਾਈ ਟਰਬਾ ਟਰਬਾਈਨ ਦੀ ਵਰਤੋਂ ਬਿਜਲੀ ਨਾ ਵਾਲੇ ਵਾਟਰ ਫਿਲਟਰੇਸ਼ਨ ਸਿਸਟਮ ਸਾਫ ਪਾਣੀ ਦੀ ਪ੍ਰਾਪਤੀ ਲਈ ਜਿਵੇਂ ਕਿ ਮਾਈਕਰੋ ਫਿਲਟਰ ਅਤੇ ਓਲਡ ਰੀਵਰ ਸਿਸਟਮ ਕਰਾਪ ਮਾਈਨਿੰਗ ਡਰੋਨ ਅਤੇ ਸੈਂਸਰ ਦੀ ਵਰਤੋਂ ਕਰਕੇ ਫਸਲਾਂ ਦੀ ਸਿਹਤ ਤੇ ਮਿੱਟੀ ਸਥਿਤੀ ਨੂੰ ਮਾਈਨ ਮਾਈਟਰਿੰਗ ਐਗਰੀਕਲਚਰ ਰਿਬੋਟਕਿਸ ਰਿਬੋਟਾਂ ਦਾ ਉਪਯੋਗ ਕਰਕੇ ਫਸਲਾਂ ਦੀ ਤਿਆਰੀ ਕਟਾਈ ਅਤੇ ਪੈਕੇਜਿੰਗ ਪਾਣੀ ਦੀ ਵਰਤੋਂ ਨੂੰ ਘਟਾਉਣ ਲਈ ਅਤੇ ਮਾਈਕਰੋਗਰੇਸ਼ਨ ਸਿਸਟਮਾਂ ਦਾ ਅਪਣਾਉਣਾ ਕੁਝ ਖੇਤੀਬਾੜੀ ਦੀ ਕਾਰਜ ਨਾਲ ਹੀ ਨੈਚੁਰਲ ਗੈਸ ਉਪਯੋਗ ਕਰਨ ਵਾਲੀ ਮਸ਼ੀਨ ਜੈਵੀਕ ਊਰਜਾ ਨੂੰ ਪੈਦਾ ਕਰਨ ਲਈ ਕਚਰੇ ਦਾ ਪ੍ਰਿਆਕਰਨ ਇਹ ਸਾਰੇ ਤਕਨੀਕਾਂ ਖੇਤੀ ਲਈ ਖੇਤੀ ਵਿੱਚ ਬਿਜਲੀ ਦੇ ਲਾਗਤਾਂ ਨੂੰ ਘਟਾਉਣ ਅਤੇ ਫਸਲਾਂ ਦੀ ਦੇ ਉਤਪਾਦਨ ਵਿੱਚ ਬਹੁਤ ਸਹਾਇਤਾ ਕਰਦੀਆਂ ਹਨ